ਪੰਜਾਬ ਵਿੱਚ ਪਰ ਬਾਬਾ ਰਾਮਦੇਵ ਜੀ ਪ੍ਰਸਿੱਧ ਯੋਗ ਗੁਰੂ ਹਨ ਇਹਨਾਂ ਦਾ ਜਨਮ ਪੱਚੀ ਦਸੰਬਰ ਉੱਨੀ ਸੌ ਪੈਂਹਟ ਦਾ ਹੈ ਇਹ ਸੱਠ ਸਾਲ ਦੇ ਵੀ ਹੋ ਕੇ ਸਾਨੂੰ ਯੋਗਾ ਲਈ ਪ੍ਰੇਰ ਪ੍ਰੇਰਿਤ ਕਰਦੇ ਸਨ ਜਿਵੇਂ ਕਿ ਉਹ ਪੰਜਾਬ ਦੇ ਰਹਿਣ ਵਾਲੇ ਹਨ ਪਰ ਥਾਂ ਥਾਂ ਜਾ ਕੇ ਵੱਖਰੀਆਂ ਵੱਖਰੀਆਂ ਥਾਵਾਂ ਉੱਤੇ ਆਪਣਾ ਯੋਗਾ ਟੈਂਟ ਲਗਾ ਕੇ ਦਿਖਾਉਂਦੇ ਹਨ ਅਤੇ ਜੋ ਲੋਕ ਇਹਨਾਂ ਨੂੰ ਮੰਨਦੇ ਹਨ ਉਹ ਵੀ ਇਹਨਾਂ ਦਾ ਹਿੱਸਾ ਬਣਦੇ ਹਨ ਬਾਬਾ ਰਾਮਦੇਵ ਜੀ ਸੱਠ ਸਾਲ ਦੀ ਉਮਰ ਵਿੱਚ ਵੀ ਇੰਨੇ ਵਧੀਆ ਤੰਦਰੁਸਤ ਅਤੇ ਫਿੱਟ ਹੈਲਦੀ ਹਨ ਅਤੇ ਉਹ ਸਾਨੂੰ ਬਹੁਤ ਹੀ ਵਧੀਆ ਮੋਟੀਵੇਸ਼ਨ ਦਿੰਦੇ ਹਨ ਜਿਵੇਂ ਕਿ ਕਿ ਸਾਨੂੰ ਵੀ ਇਹ ਕਰਨਾ ਚਾਹੀਦਾ ਹੈ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੀਆਂ ਹੀ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ ਇਹ ਬਾਹਰਲਾ ਖਾ ਖਾ ਕੇ ਹੁੰਦਾ ਹੈ ਪਰ ਜੇ ਅਸੀਂ ਬਾਬਾ ਰਾਮਦੇਵ ਜੀ ਨੂੰ ਫੋਲੋ ਕਰੀਏ ਤਾਂ ਸਾਡਾ ਅਸੀਂ ਵੀ ਸੱਠ ਸਾਲ ਦੀ ਉਮਰ ਵਿੱਚ ਇੰਨੇ ਵਧੀਆ ਫਿਟ ਐਂਡ ਹੈਲਦੀ ਰਹਿ ਸਕਦੇ ਹਾਂ ਜੇ ਅਸੀਂ ਸੁਬਹਾ ਸੁਬਹਾ ਥੋੜ੍ਹੀ ਦੇਰ ਹੀ ਯੋਗਾ ਕਰੀਏ ਤਾਂ ਸਾਨੂੰ ਰੋਜ਼ ਦੀ ਆਦਤ ਆਪਣੇ ਆਪ ਲੱਗ ਜਾਵੇਗੀ